ਮੋਹਾਲੀ ਜ਼ਿਲ੍ਹੇ ਵਿੱਚ ਮੁੱਖ ਵਿੱਦਿਅਕ ਅਦਾਰੇ ਸਕੂਲ ਕੋਲਜ ਅਤੇ ਯੂਨੀਵਰਸਿਟੀਆਂ ਹੀ ਹਨ ਇੱਥੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੋਨਾਂ ਦੀ ਹੀ ਬਿਲਕੁਲ ਕਮੀ ਨਹੀਂ ਹੈ ਸਰਕਾਰੀ ਸਕੂਲਾਂ ਦੀ ਗੱਲ਼ ਕਰੀਏ ਤਾਂ ਜੋ ਪਿੰਡਾਂ ਦੇ ਲੋਗ ਨੇ ਉਹ ਸਰਕਾਰੀ ਸਕੂਲਾਂ ਵਿੱਚ ਭੇਜਣਾ ਹੀ ਆਪਣੇ ਬੱਚਿਆਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਹਨ ਕਿਉਂਕਿ ਸਰਕਾਰੀ ਸਕੂਲਾਂ ਦੀਆਂ ਫੀਸਾਂ ਪ੍ਰਾਈਵੇਟ ਨਾਲੋਂ ਬਹੁਤ ਹੀ ਘੱਟ ਹਨ ਜੇ ਅਤੇ ਇੱਥੇ ਮਿਡ ਡੇ ਮੀਲ ਸਕੀਮ ਫ੍ਰੀ ਬੁੱਕਸ ਫ੍ਰੀ ਯੂਨੀਫੋਮ ਵਗੈਰਾ ਸਭ ਕੁਛ ਪ੍ਰੋਵਾਇਡ ਕੀਤਾ ਜਾਂਦਾ ਬਟ ਜੋ ਕਿ ਪ੍ਰਾਇਵੇਟ ਸਕੂਲਾਂ ਵਿੱਚ ਇਹ ਸਭ ਅਵੇਲੇਵਲ ਨਹੀਂ ਹੈ ਅਤੇ ਕੋਲਜਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਕੋਲਜ ਵਿੱਚ ਸਕ ਸਰਕਾਰੀ ਕੋਲਜਾਂ ਨਾਲ਼ੋਂ ਜ਼ਿਆਦਾ ਫੈਸੀਲਿਟੀਜ਼ ਹਨ ਉੱਥੇ ਪ੍ਰੋਪਰ ਸ ਕਲਾਸਰੂਮ ਵਗੈਰਾ ਸਮਾਟ ਕਲਾਸਿਸ ਵਗੈਰਾ ਪ੍ਰੋਵਾਇਡ ਕੀਤੀਆਂ ਜਾਂਦੀਆਂ ਹਨ ਬਟ ਸਰਕਾਰੀ ਸਕੂਲਾਂ ਵਿ ਕੋਲਜਾਂ ਵਿੱਚ ਇਹ ਸਭ ਅਵੇਲੇਵਲ ਨਹੀ ਹੈ ਅਤੇ ਪਿੰਡ ਪਿੰਡ ਬੱਸ ਭੇਜਦੇ ਹਨ ਪਰ ਪ੍ਰਾਈਵੇਟ ਕੋਲਜ ਵਾਲੇ ਅਤੇ ਸਰਕਾਰੀਆਂ ਚੋ ਖ਼ੁਦ ਬੱਸ ਚੋਂ ਖੱਜਲ ਹੋ ਕੇ ਰੋਜ਼ ਜਾਣਾ ਪੈਂਦਾ ਏ ਘਰ ਤੋਂ ਅਤੇ ਉੱਥੇ ਫਿਰ ਆਪਣਾ ਜੋ ਆਪਾਂ ਜਾਂਦੇ ਹਾਂ ਉਸਦਾ ਪੂਰਾ ਬੈਨੀਫਿਟ ਵੀ ਨਹੀ ਮਿਲਦਾ ਆਪਾਂ ਨੂੰ ਕਿਉਂਕਿ ਉੱਥੇ ਪ੍ਰੋਪਰ ਕਲਾਸਿਸ ਵਗੈਰਾ ਦਾ ਕੋਈ ਸ਼ਡਿਊਲ ਨਹੀਂ ਹੁੰਦਾ ਕੋਈ ਕਿਸੇ ਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਹੈ ਕੋਈ ਸਟੂਡੈਂਟ ਆ ਰਿਹਾ ਅਟੈਂਡੈਂਸ ਵਗੈਰਾ ਪ੍ਰੋਪਰ ਨਹੀਂ ਹੁੰਦਾ ਬਾਕੀ ਜੇ ਫਾਇਦੇ ਦੀ ਗੱਲ਼ ਕਰੀਏ ਜਣੀ ਕਿ ਮੈਂ ਤਾਰੀਫ਼ ਕਰਾ ਸਰਕਾਰੀ ਕੋਲਜਾਂ ਦੀ ਤਾਂ ਇੱਥੇ ਕੋਰਸਿਸ ਦੀ ਕਮੀ ਬਿਲਕੁਲ ਨਹੀਂ ਹੈ ਇੱਥੇ ਸਾਰੇ ਕੋਰਸਿਸ ਹੀ ਅਵੇਲੇਵਲ ਹੈ ਜਿਵੇਂ ਕਿ ਬੀ ਕੌਮ ਬੀ ਏ ਬੀ ਐੱਸ ਸੀ ਐੱਮ ਕੌਮ ਬੀ ਸੀ ਏ ਐੱਲ ਐੱਲ ਬੀ ਡਿਪਲੋਮਾ ਵਗੈਰਾ ਵੀ ਹਨ ਤਾਂ ਇਹ ਇੱਕ ਪਿੰਡਾਂ ਦੇ ਲੋਕਾਂ ਲਈ ਸ ਵਧੀਆ ਗੱਲ ਵੀ ਹੈ ਕਿ ਉਹਨਾਂ ਨੂੰ ਸ਼ਹਿਰ ਵਿੱਚ ਨਹੀਂ ਜਾਣਾ ਪੈਂਦਾ ਹੁਣ ਇੰਨੀ ਦੂਰ ਕੋਰਸਿਸ ਲਈ ਆਪਣੇ ਖ਼ੁਦ ਦੇ ਏਰੀਏ ਵਿੱਚ ਹੀ ਚੁਣ ਸਕਦੇ ਹਨ